ਚਿੱਤਰਕਾਰੀ ਕਰਦੇ ਸਮੇਂ ਅਸੀਂ ਬੋ ਅਸੀਂ ਅਪਸਰਾਂ ਡੋਮਸ ਜਾਂ ਕਿਸੇ ਕਿਸਮ ਦੀ ਸਪਲਾਈ ਕਰਦੇ ਹਨ ਇਹ ਇੱਕ ਬਹੁਤ ਵਧੀਆ ਗਿਆਨ ਹੈ ਚਿੱਤਰਕਾਰੀ ਇਸ ਨਾ ਅਪਸਰਾਂ ਜਾਂ ਡੋਮਸ ਦੇ ਕਲਰਸ ਨਾਲ ਚਿੱਤਰਕਾਰੀ ਬਹੁਤ ਵਧੀਆ ਹੁੰਦੀ ਹੈ ਮੈਂ ਜ਼ਿਆਦਾਤਰ ਆਪਣੇ ਆਪਣੇ ਕਲਰ ਐਮਾਜ਼ੋਨ ਜਾਂ ਫਲਿੱਪਕਾਰਟ ਤੋਂ ਬੁਕਿੰਗ ਕਰਵਾਉਂਦਾ ਹਾਂ ਇਹਨਾਂ ਵਿੱਚ ਬਹੁਤ ਵਧੀਆ ਫਰੈਸ਼ ਪੀਸ ਮਿਲ ਜਾਂਦੇ ਹਨ ਇਹਦੇ ਵਿੱਚ ਬਹੁਤ ਜ਼ਿਆਦਾ ਵਰਾਇਟੀ ਮਿਲ ਜਾਂਦੀ ਹੈ ਜਦੋਂ ਕਿ ਦੁਕਾਨਾਂ ਵਿੱਚ ਪੁਰਾਣਾ ਸਸਤਾ ਮਾਲ ਪਿਆ ਹੁੰਦਾ ਹੈ ਜੋ ਚਿੱਤਰਕਾਰੀ ਨੂੰ ਉਸ ਚਿੱਤਰਕਾਰੀ ਨੂੰ ਜ਼ਿਆਦਾ ਸੁੰਦਰ ਨਹੀਂ ਬਣਾਉਂਦਾ ਅਤੇ ਜ਼ਿਆਦਾਤਰ ਇਹ ਟੁੱਟ ਜਾਂਦਾ ਹੈ ਚਿੱਤਰਕਾਰੀ ਇਸ ਸਮੇਂ ਦੇ ਵਿੱਚ ਬਹੁਤ ਵੱਡਾ ਗਿਆਨ ਹੈ ਕਈ ਬੱਚੇ ਬਹੁਤ ਵਧੀਆ ਚਿੱਤਰ ਬਣਾਉਂਦੇ ਹਨ ਅਤੇ ਪਰ ਉਹ ਉਹਨਾਂ ਉਹ ਸਭ ਅੱਜ ਕੱਲ੍ਹ ਦੇ ਸਾਡੇ ਮੁਹੱਲੇ ਵਿੱਚ ਬਹੁਤ ਜ਼ਿਆਦਾਤਰ ਬੱਚੇ ਚਿੱਤਰਕਾਰੀ ਵਿੱਚ ਅਪਸਰਾਂ ਜਾਂ ਡੋਮਸ ਦੇ ਪੈੱਨ ਯੂਜ ਕਰਦੇ ਹਨ